ਬੈਂਕਿੰਗ ਦੇ ਬਹੁਤ ਤਰ੍ਹਾਂ ਦੇ ਵੱਖਰੇ ਵੱਖਰੇ ਤਰੀਕੇ ਹਨ ਉੱਥੇ ਜਾ ਕੇ ਵੀ ਬੈਂਕਿੰਗ ਦੇ ਵਿੱਚੋਂ ਆਪਾਂ ਮਦਦ ਲੈ ਸਕਦੇ ਹਨ ਅਤੇ ਅੱਜ ਕੱਲ੍ਹ ਆਨਲਾਈਨ ਜਿਸਨੂੰ ਇੰਟਰਨੈਟ ਬੈਂਕਿੰਗ ਵੀ ਕਿਹਾ ਜਾਂਦਾ ਹੈ ਉਸ ਦੀ ਵੀ ਮਦਦ ਲਈ ਜਾ ਸਕਦੀ ਹੈ ਮੈਂ ਦੋਹੇ ਤਰ੍ਹਾਂ ਦੀਆਂ ਵਿਧੀਆ ਨੂੰ ਤਰਜੀਹ ਦਿੰਦਾ ਹਾਂ ਕਿਉਂਕਿ ਜਿਹੜੀ ਤਰਜੀ ਜਿਹੜੀ ਚਿਹਰੇ ਵਿਧੀ ਹੈ ਨਿੱਜੀ ਚਿਹਰੇ ਨਾਲ ਜਿਹੜੀ ਬੈਂਕਿੰਗ ਦੀ ਸਹੂਲਤ ਲੈਣੀ ਹੈ ਉਸ ਦੇ ਨਾਲ ਇਹ ਫਾਇਦਾ ਹੁੰਦਾ ਹੈ ਕਿ ਤੁਹਾਨੂੰ ਇੱਕ ਸਟਾਫ ਮੈਂਬਰ ਦੇ ਉੱਤੇ ਯਕੀਨ ਹੁੰਦਾ ਹੈ ਇੱਕ ਮੈਨੇਜਰ ਦੇ ਉੱਤੇ ਯਕੀਨ ਹੁੰਦਾ ਹੈ ਤੁਸੀਂ ਉਹਦੀ ਮਦਦ ਲੈ ਸਕਦੇ ਹੋ ਅਤੇ ਜਾ ਕੇ ਆਪਣੇ ਸਰੀਰਿਕ ਸਰੂਪ ਦੇ ਵਿੱਚ ਤੁਸੀਂ ਉਹਦੇ ਨਾਲ ਜਦੋਂ ਗੱਲਬਾਤ ਕਰਦੇ ਹਨ ਤਾਂ ਤੁਹਾਡਾ ਜਿਹੜਾ ਮਨੋਬਲ ਹੈ ਉਹ ਵੱਧਦਾ ਹੈ ਅਤੇ ਤੁਹਾਡੀ ਮੈਂ ਤੁਹਾਡੀ ਮਨੋਵਿਗਿਆਨਿਕ ਤੌਰ 'ਤੇ ਇਹ ਵਿਧੀ ਹੈ ਇਹ ਦਿਮਾਗੀ ਸੰਤੁਲਨ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਬੈਂਕਿੰਗ ਕਰਨ ਨਾਲ ਤੁਹਾਨੂੰ ਇੱਕ ਯਕੀਨ ਜ਼ਿਆਦਾ ਜਲਦੀ ਬਣਦਾ ਹੈ ਪਰ ਆਨਲਾਈਨ ਬੈਂਕਿੰਗ ਦਾ ਫ਼ਾਇਦਾ ਇਸ ਤਰ੍ਹਾਂ ਨਾਲ ਹੈ ਕਿ ਇੰਟਰਨੈਟ ਬੈਂਕਿੰਗ ਅਤੇ ਆਨਲਾਈਨ ਬੈਂਕਿੰਗ ਨਾਲ ਅਸੀਂ ਆਪਣਾ ਕੰਮ ਬਹੁਤ ਆਸਾਨ ਕਰ ਸਕਦੇ ਹਾਂ ਅਸੀਂ ਘਰੋਂ ਬੈਠੇ ਹੀ ਆਪਣਾ ਸਾਰਾ ਜਿਹੜਾ ਖਾਤਾ ਹੈ ਉਹਨੂੰ ਉਹਨੂੰ ਸਾਂਭ ਉਹਦੀ ਸਾਂਭ ਸੰਭਾਲ ਕਰ ਸਕਦੇ ਹਾਂ ਪੈਸੇ ਦਾ ਲੈਣ ਦੇਣ ਕਰ ਸਕਦੇ ਹਨ ਇਸ ਨਾਲ ਸਾਡਾ ਸਮੇਂ ਵੀ ਬਹੁਤ ਬਚੇਗਾ ਕਿਉਂਕਿ ਚਿਹਰਾ ਬੈਂਕਿੰਗ ਦੇ ਦੌਰਾਨ ਸਾਨੂੰ ਉੱਥੇ ਆਪ ਜਾ ਕੇ ਉੱਥੇ ਪੇਸ਼ ਹੋਣਾ ਪਵੇਗਾ ਉੱਥੇ ਜਾ ਕੇ ਕੰਮ ਕਰਨਾ ਪਵੇਗਾ ਪਰ ਆਨਲਾਈਨ ਬੈਂਕਿੰਗ ਦੇ ਦੌਰਾਨ ਅਸੀਂ ਘਰੋਂ ਬੈਠੇ ਹੀ ਜਾਂ ਕਿਸੇ ਸਫ਼ਰ ਕਰਦੇ ਦੌਰਾਨ ਕਿਸੇ ਰਸਤੇ ਦੇ ਵਿੱਚ ਕਿਸੇ ਕੰਮ ਦੇ ਉੱਤੇ ਬੈਠੇ ਅਸੀਂ ਆਪਣਾ ਸਾਰਾ ਕੰਮ ਕਰ ਸਕਦੇ ਹਾਂ